ਮੈਂ ਪਿਛਲੇ ਤਿੰਨ ਸਾਲ ਤੋਂ ਪਹਿਲਾਂ ਡਰਾਇੰਗ ਕਰ ਰਹੀ ਹਾਂ ਮੈਨੂੰ ਡਰਾਇੰਗ ਕਰਨਾ ਬਹੁਤ ਹੀ ਵਧੀਆ ਲੱਗਦਾ ਹੈ ਮੈਨੂੰ ਡਰਾਇੰਗ ਕਰਨ ਨਾਲ ਮੇਰੇ ਮਨ ਦੇ ਅੰਦਰ ਸ਼ਾਂਤੀ ਮਿਲਦੀ ਹੈ ਮੈਂ ਦਿਨ ਵਿੱਚ ਆਪਣੇ ਰੋਜ਼ਾਨਾ ਕੰਮ ਦੇ ਨਾਲ ਨਾਲ ਡਰਾਇੰਗ ਜ਼ਰੂਰ ਕਰਦੀ ਹਾਂ ਮੈਂ ਦਿਨ ਵਿੱਚ ਕਈ ਤਰ੍ਹਾਂ ਦੀ ਤਸਵੀਰਾਂ ਬਣਾਉਂਦੀ ਹਾਂ ਅਤੇ ਉਨ੍ਹਾਂ ਨੂੰ ਦੇ ਨਾਲ ਨਾਲ ਮੈਂ ਕਈ ਤਰ੍ਹਾਂ ਦੇ ਵਸਤੂਆਂ ਦੀ ਵੀ ਤਸਵੀਰਾਂ ਬਣਾਉਂਦੀ ਹਾਂ ਮੈਨੂੰ ਡਰਾਇੰਗ ਕਰਨਾ ਇੰਨਾ ਜ਼ਿਆਦਾ ਵਧੀਆ ਲੱਗਦਾ ਹੈ ਕਿ ਮੈਂ ਆਪਣਾ ਕੰਮ ਛੱਡ ਕੇ ਪਹਿਲਾਂ ਡਰਾਇੰਗ ਕਰਦੀ ਹਾਂ ਇਹ ਸ਼ੌਕ ਮੈਨੂੰ ਤਿੰਨ ਸਾਲ ਪਹਿਲਾਂ ਸਾਡੇ ਸਕੂਲ ਦੇ ਵਿੱਚ ਇੱਕ ਮਾਸਟਰ ਆਇਆ ਸੀ ਉਸਨੇ ਸਾਨੂੰ ਕਈ ਤਰ੍ਹਾਂ ਦੀ ਡਰਾਇੰਗ ਬਣਾ ਕੇ ਦਿਖਾਈਆਂ ਉਨ੍ਹਾਂ ਦੀ ਡਰਾਇੰਗ ਤੋਂ ਮੈਂ ਇੰਨਾ ਆਕਰਸ਼ਿਤ ਹੋਈ ਕਿ ਮੇਰੇ ਅੰਦਰ ਵੀ ਇੱਕ ਸ਼ੌਕ ਜਾਗਿਆ ਜਿਸ ਕਰਕੇ ਮੈਂ ਵੀ ਸੋਚਿਆ ਕਿ ਮੈਂ ਵੀ ਡਰਾਇੰਗ ਕਰ ਸਕਦੀ ਹਾਂ ਇਸ ਲਈ ਉਨ੍ਹਾਂ ਨੂੰ ਵੇਖ ਕੇ ਮੈਂ ਕਈ ਤਰ੍ਹਾਂ ਦੀਆਂ ਡਰਾਇੰਗ ਬਣਾਈਆਂ ਅਤੇ ਸ਼ੁਰੂ ਸ਼ੁਰੂ ਵਿੱਚ ਮੈਂ ਠੀਕ ਠੀਕ ਡਰਾਇੰਗ ਬਣਾਉਂਦੀ ਸੀ ਪ੍ਰੰਤੂ ਬਾਅਦ ਵਿੱਚ ਮੈਂ ਬਹੁਤ ਵਧੀਆ ਡਰਾਇੰਗ ਕਰਨ ਲੱਗ ਗਈ ਇਸ ਲਈ ਇਹ ਮੇਰਾ ਇੱਕ ਸ਼ੌਕ ਬਣ ਗਿਆ ਹੈ ਇਸ ਲਈ ਮੈਨੂੰ ਡਰਾਇੰਗ ਕਰਨਾ ਬਹੁਤ ਹੀ ਜ਼ਿਆਦਾ ਪਸੰਦ ਹੈ